ਪੰਜਾਬ ਵਿੱਚ ਪਹਿਲੇ ਸਮਿਆਂ ਵਿੱਚ ਲੋਕ ਕਲਾ ਅਤੇ ਸ਼ਿਲਪਕਾਰੀ ਨਾਲ ਜੁੜੇ ਸੀ ਉਸ ਸਮੇਂ ਲੋਕ ਬਹੁਤ ਤਰੀਕਿਆਂ ਦੀ ਕਲਾ ਅਤੇ ਸ਼ਿਲਪਕਾਰੀ ਕਰਦੇ ਸੀ ਜਿਵੇਂ ਔਰਤਾਂ ਘਰਾਂ ਵਿੱਚ ਬੈਠ ਕੇ ਹੱਥੀਂ ਕਢਾਈ ਦਾ ਕੰਮ ਕਰਦੀਆਂ ਸਨ ਜਿਵੇਂ ਫੁਲਕਾਰੀ ਅਤੇ ਬਾਗ ਤਿਆਰ ਕੀਤੇ ਜਾਂਦੇ ਸਨ ਕੁੜੀਆਂ ਆਪਣੇ ਵਿਆਹ ਲਈ ਖੁਦ ਹੱਥੀਂ ਚਾਦਰਾਂ ਕੱਢਦੀਆਂ ਸਨ ਉਸ ਸਮੇਂ ਪੱਥਰਾਂ 'ਤੇ ਲੱਕੜ 'ਤੇ ਦਰਵਾਜ਼ਿਆਂ ਅਤੇ ਅਲਮਾਰੀਆਂ ਉੱਪਰ ਤਰ੍ਹਾਂ ਤਰ੍ਹਾਂ ਦੀ ਸ਼ਿਲਪਕਾਰੀ ਕੀਤੀ ਜਾਂਦੀ ਸੀ ਉਸ ਸਮੇਂ ਦੇ ਲੋਕ ਹੱਥੀਂ ਕੰਮ ਕਰਨ ਵਿੱਚ ਵਿਸ਼ਵਾਸ਼ ਰੱਖਦੇ ਸਨ ਜਿਸ ਨਾਲ ਉਸ ਸਮੇਂ ਦੇ ਲੋਕ ਕਲਾ ਅਤੇ ਸ਼ਿਲਪਕਾਰੀ ਨਾਲ ਜੁੜੇ ਸਨ ਪਰ ਹੁਣ ਦੇ ਸਮੇਂ ਵਿੱਚ ਲੋਕ ਆਪਣਾ ਵਿਰਸਾ ਭੁੱਲਦੇ ਜਾ ਰਹੇ ਹਨ ਹੁਣ ਦੇ ਸਮੇਂ ਵਿੱਚ ਲੋਕ ਕਲਾ ਅਤੇ ਸ਼ਿਲਪਕਾਰੀ ਤੋਂ ਦੂਰ ਹੁੰਦੇ ਜਾ ਰਹੇ ਹਨ ਅਤੇ ਵਿਦੇਸ਼ੀ ਚੀਜ਼ਾਂ ਅਪਣਾ ਰਹੇ ਹਨ ਇਸ ਸਮੇਂ ਵਿੱਚ ਲੋੜ ਹੈ ਅਸੀਂ ਐਗਜੀਵੀਸ਼ਨ ਦੇ ਰਾਹੀਂ ਮੇਲਿਆਂ ਦੇ ਰਾਹੀਂ ਉਨ੍ਹਾਂ ਨੂੰ ਪਰਾਣੀਆਂ ਵਿਰਾਸਤਾਂ ਦਿਖਾਈਆਂ ਜਾਣ ਅਤੇ ਆਪਣੇ ਪੁਰਾਣੇ ਸੱਭਿਆਚਾਰ ਨਾਲ ਜੋੜਿਆ ਜਾਵੇ ਤਾਂ ਜੋ ਉਹ ਇਹ ਪੁਰਾਣੀਆਂ ਚੀਜ਼ਾਂ ਖਰੀਦਣ ਅਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਪਤਾ ਲੱਗ ਸਕੇ ਕਿ ਕਲਾ ਅਤੇ ਸ਼ਿਲਪਕਾਰੀ ਕੀ ਸੀ ਉਹ ਵੀ ਇਸ ਨੂੰ ਜਾਣ ਸਕਣ ਇਸ ਤਰ੍ਹਾਂ ਅਸੀਂ ਆਪਣੇ ਮੁੱਦੇ ਨੂੰ ਹੱਲ ਕਰ ਸਕਦੇ ਹਾਂ ਜੋ ਕਿ ਹੁਣ ਖੁਸਦਾ ਜਾ ਰਿਆ ਹੈ